ਸਤਿ ਸ਼੍ਰੀ ਅਕਾਲ ਜੀ ਮੈਂ ਡਿਸਟਰਿਕਟ ਕਪੂਰਥਲੇ ਤੋਂ ਗੱਲ ਕਰ ਰਿਹਾ ਹਜੇ ਹੀ ਅ ਹਾਲੇ ਹੀ ਮੈਂ ਆਪਣੀ ਇਕ ਪਰਚੂਨ ਦੀ ਦੁਕਾਨ ਖੋਲ੍ਹੀ ਹੋਈ ਹੈ ਅਤੇ ਮੈਂ ਅ ਜੀ ਐਸ ਟੀ ਨੰਬਰ ਲਈ ਅਪਲਾਈ ਕੀਤਾ ਹੋਇਆ ਹੈ ਕੀ ਮੈਂ ਜਾਣ ਸਕਦਾ ਹਾਂ ਕਿ ਅ ਮੇਰਾ ਜਿਹੜਾ ਰੀਐਸ ਅ ਜੀ ਐਸ ਟੀ ਰਜਿਸਟਰੇਸ਼ਨ ਹੈ ਉਹ ਹਜੇ ਤੱਕ ਹੋਇਆ ਕਿ ਨਹੀਂ ਹੋਇਆ ਮੈਂ ਅ ਕਾਫੀ ਅ ਮ ਪ੍ਰੋਬਲਮ ਦੀ ਫੇਸ ਕਰ ਰਿਹਾ ਕਾਫੀ ਟਾਈਮ ਤੋਂ ਮੈਨੂੰ ਮੇਰਾ ਜੀ ਐਸ ਟੀ ਨੰਬਰ ਨਹੀਂ ਮਿਲਿਆ ਹੈ ਜਦੋਂ ਇੱਕ ਵਾਰ ਮੈਨੂੰ ਵੀ ਮੇਰਾ ਜੀ ਐਸ ਟੀ ਨੰਬਰ ਮਿਲ ਜਾਵੇ ਤਾਂ ਮੈਂ ਆਪਣਾ ਬਿਜ਼ਨਸ ਪ੍ਰੋਪਰ ਵੇ ਨਾਲ ਚਲਾ ਸਕਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਬਿਨਾਂ ਜੀ ਐਸ ਟੀ ਨੰਬਰ ਤੋਂ ਸਾਡੇ ਦੇਸ਼ ਵਿੱਚ ਵੱਡੇ ਲੈਵਲ ਦਾ ਕੋਈ ਵੀ ਬਿਜ਼ਨਸ ਨਹੀਂ ਕਰ ਸਕਦੇ ਹਨ ਅਤੇ ਕਿਰਪਾ ਕਰਕੇ ਤੁਹਾਡੇ ਤੇ ਬੇਨਤੀ ਹੈ ਕਿ ਜਲਦ ਤੋਂ ਜਲਦ ਮੇਰਾ ਰਜਿਸਟਰੇਸ਼ਨ ਜੀ ਐਸ ਟੀ ਰਜਿਸਟਰੇਸ਼ਨ ਨੰਬਰ ਮੈਨੂੰ ਸਬਮਿਟ ਕੀਤਾ ਜਾਵੇ ਤਾਂ ਕਿ ਮੈਂ ਆਪਣਾ ਇੱਕ ਬਿਜਨਸ ਕਰ ਸਕਾਂ ਅਤੇ ਦੇਸ਼ ਦੀ ਇਕਨੋਮੀ ਇਕਨੋਮਿਕ ਵਿੱਚ ਆਪਣਾ ਯੋਗਦਾਨ ਪਾ ਸਕਾ ਧੰਨਵਾਦ